ਸਾਡਾ ਗ੍ਰਾਮ ਪੰਚਾਇਤ ਪਿੰਡ ਚੇਲੇ ਚੱਕ ਡਾਕਖਾਨਾ ਮਰਾੜਾ ਅਤੇ ਤਹਿਸੀਲ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਹੈ ਸਾਡੇ ਪਿੰਡ ਦੇ ਵਿੱਚ ਸੈਰ ਸਪਾਟੇ ਲਈ ਸਾਡੇ ਕੋਲ ਗਰਾਊਂਡ ਇੱਕ ਮਿਲੀ ਹੋਈ ਹੈ ਜਿਹੜੀ ਕਿ ਪੰਚਾਇਤੀ ਜ਼ਮੀਨ ਦੇ ਵਿੱਚੋਂ ਦੋ ਕਿੱਲੇ ਕੱਟੀ ਹੋਈ ਹੈ ਉਹਨਾਂ ਦੀ ਹਾਲਤ ਬਹੁਤ ਖਸਤਾ ਹੈ ਲੇਡੀਜ ਜਾਂਦੀਆਂ ਨਾ ਸਵੇਰ ਸ਼ਾਮ ਸੈਰ ਕਰਨ ਪਰ ਬੜਾ ਏਰੀਆ ਵਧੀਆ ਸਾਫ਼ ਸੁਥਰਾ ਨਾ ਹੋਣ ਕਰਕੇ ਪਰ ਚਿੱਕੜ ਗਾਰਾ ਹੋਣ ਕਰਕੇ ਉਹਨੂੰ ਵਧੀਆ ਸੁਧਾਰ ਕਰਨਾ ਚਾਹੀਦਾ ਸਰਕਾਰ ਵੱਲੋਂ ਵੀ ਅਤੇ ਪੰਚਾਇਤੀ ਫੰਡ ਵਿੱਚੋਂ ਵੀ ਉਹਨੂੰ ਸੁਧਾਰਨਾ ਚਾਹੀਦਾ ਸਾਫ਼ ਸੁਥਰੀ ਬਣਾਉਣਾ ਚਾਹੀਦਾ ਲੈਵਲਾਈਜ਼ ਕਰਵਾਉਣਾ ਚਾਹੀਦਾ ਹੈ ਔਰ ਜੋ ਸਾਡੇ ਸ ਸੜਕਾਂ ਪਿੰਡ ਦੀਆਂ ਆਉਣ ਜਾਣ ਵਾਸਤੇ ਜੋ ਪਾਰਕ ਵੱਲ ਨੂੰ ਜਾਂਦੀਆਂ ਉਹਨਾਂ ਦਾ ਬਹੁਤ ਬੁਰਾ ਹਾਲਤ ਹੈ ਜੋ ਕਿ ਦਸ ਸਾਲ ਤੋਂ ਨਹੀਂ ਬਣੀਆਂ ਠੀਕ ਹੈ ਜੀ ਅਤੇ ਇਹ ਹੈ ਸੜਕਾਂ ਵੱਲ ਵੀ ਸਾਡੀ ਸਰਕਾਰ ਜਾਂ ਸਾਡੀਆਂ ਪੰਚਾਇਤਾਂ ਧਿਆਨ ਦੇਣ ਅਤੇ ਨਾਲੀਆਂ ਦਾ ਵੀ ਬੁਰਾ ਹਾਲ ਹੈ ਸਾਡੇ ਕੋਲ ਗੌਰਮੈਂਟ ਨੇ ਨਰੇਗਾ ਸਕੀਮ ਦਿੱਤੀ ਹੋਈ ਹੈ ਇੱਕ ਇੱਕ ਪੰਚਾਇਤੀ ਫੰਡ ਇਹ ਨੋਟ ਕੀਤਾ ਜਾਵੇ ਕਿ ਪੰਜ ਸਾਲ ਵਿੱਚ ਪੰਜਾਬ ਗੌਰਮੈਂਟ ਕਿੰਨਾ ਪੈਸਾ ਦੇ ਰਹੀ ਹੈ ਅਤੇ ਨਰੇਗਾ ਪੰਜ ਸਾਲ ਦੇ ਵਿੱਚ ਕਿੰਨਾ ਪੈਸਾ ਉਹਨੇ ਯੂਜ਼ ਕੀਤਾ ਹੈ ਔਰ ਉਹਨਾਂ ਦੀ ਆਉਟਪੁੱਟ ਦੇਖੀ ਜਾਏ ਤਾਂ ਜ਼ੀਰੋ ਬਰਾਬਰ ਹੈ ਨਾਮਾਤਰ ਠੀਕ ਹੈ ਜੀ ਤੋ ਜੇ ਅਗਰ ਇਹ ਪਾਰਕਾਂ ਸੁਧਾਰੀਆਂ ਜਾਣ ਠੀਕ ਹੈ ਜੀ ਅਤੇ ਬੱਚਿਆਂ ਦੇ ਖੇਡਣ ਨੂੰ ਜੋ ਜਿਮ ਖੁਲ੍ਹ ਰਹੇ ਹੈ ਉਹ ਜਿਮ ਦੀ ਵੀ ਸ ਸਮੱਸਿਆ ਸਾਡੇ ਪਿੰਡ ਅਜੇ ਤੱਕ ਨਹੀਂ ਲੱਗਿਆ ਤਿੰਨ ਚਾਰ ਪੰਚਾਇਤਾ ਚਲ ਗਈਆਂ ਅੱਜ ਤੋਂ ਦਸ ਪੰਦਰ੍ਹਾਂ ਸਾਲ ਤੋਂ ਸਾਡੀਆਂ ਲੋਕਲ ਜੋ ਕਿ ਲਿੰਕ ਰੋਡ ਹੈ ਨਹੀਂ ਬਣਿਆ ਸਾਨੂੰ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਸਹੂਲਤ ਨਹੀਂ ਕੋਈ ਸੜਕ ਬਣਨ ਦੀ ਪੰਜਾਬ ਗੋਰਮੈਂਟ ਵੱਲੋਂ ਕੋਈ ਫ਼ਾਇਦਾ ਹੀ ਨਹੀਂ ਦੋ ਵਾਰ ਵੋਟਾਂ ਪਾਈਆਂ ਸੀਮਾ ਦੇਵੀ ਇਕ ਵਾਰ ਐਮ ਐਲ ਏ ਰਹੀ ਹੈ ਉਹਨੂੰ ਬਣਾਇਆ ਸੀ ਜਗਿੰਦਰਪਾਲ ਵੀ ਇੱਦਾਂ ਹੀ ਚਲਾ ਗਿਆ ਅਤੇ ਹੁਣ ਇਹ ਵੀ ਚੱਲ ਗਿਆ ਇੱਦਾਂ ਹੀ ਅਤੇ ਕਿਸੇ ਨੇ ਕੱਖ ਨਹੀਂ ਬਣਾਇਆ ਅਤੇ ਕਿਰਪਾ ਕਰਕੇ ਪਾਰਕ ਅਤੇ ਸੜਕਾਂ ਸਾਡੀਆਂ ਧਿਆਨ ਨਾਲ ਬਣਾਓ ਅਤੇ ਸਾਨੂੰ ਨਰਕ 'ਚੋਂ ਕੱਢੋ ਬਾਹਰ ਠੀਕ ਹੈ ਜੀ ਕੋਈ ਫਿਸ਼ ਪਾਰਕ ਏ ਜੀ ਐੱਮ ਮੋਲ ਅਤੇ ਮਿਨੀ ਗੋਆ ਠੀਕ ਹੈ ਜੀ ਇਹ ਸਾਡੇ ਲਾਗੇ ਘੁੰਮਣ ਫਿਰਨ ਦੀ ਮੇਨ ਜਗ੍ਹਾ ਹਨ ਠੀਕ ਹੈ ਜੀ